ਜਿਵੇਂ ਕਿ ਸਾਨੂੰ ਪਤਾ ਹੈ ਆਲੂ ਅਤੇ ਪੰਜਾਬੀ ਸਾਰੇ ਦੇਸ਼ ਵਿਦੇਸ਼ ਵਿੱਚ ਮਿਲ ਜਾਂਦੇ ਨੇ ਪਰ ਫਿਰ ਵੀ ਜੇਕਰ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਤਾਂ ਪੰਜਾਬੀ ਭਾਸ਼ਾ ਸਾਡੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ ਜੋ ਕਿ ਸਾਨੂੰ ਜਨਮ ਤੋਂ ਹੀ ਇਸ ਨੂੰ ਬੋਲਣ ਦਾ ਅਧਿਕਾਰ ਜਿਹੜਾ ਉਹ ਮਿਲ ਜਾਂਦਾ ਹੈ ਪੰਜਾਬੀ ਭਾਸ਼ਾ ਦੇ ਨਾਲ ਨਾਲ ਹੋਰ ਭਾਸ਼ਾਵਾਂ ਵੀ ਬਹੁਤ ਸਾਰੀਆਂ ਹਨ ਜੋ ਕਿ ਅੱਜ ਕੱਲ੍ਹ ਬੋਲਣ ਨੂੰ ਮਿਲਦੀਆਂ ਹਨ ਜਿਵੇਂ ਹਿੰਦੀ ਇੰਗਲਿਸ਼ ਇੰਗਲਿਸ਼ ਦੇ ਕਰਕੇ ਹੀ ਜਿਹੜੀ ਪੰਜਾਬੀ ਭਾਸ਼ਾ ਉਸ ਨੂੰ ਸਭ ਤੋਂ ਪਿੱਛੇ ਕੀਤਾ ਜਾ ਰਿਹਾ ਅਤੇ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਬਿਲਕੁਲ ਹੀ ਉਸ ਤਰ੍ਹਾਂ ਕਾਇਮ ਰੱਖੀਏ ਜਿਵੇਂ ਕਿ ਉਹ ਪਹਿਲਾਂ ਸੀ ਅਤੇ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਬਹੁਤ ਸਾਰੀਆਂ ਕਵਿਤਾਵਾਂ ਹਨ ਜੇਕਰ ਪੰਜਾਬੀ ਭਾਸ਼ਾ ਦੇ ਇਤਿਹਾਸ ਦੀ ਗੱਲ ਕਰੀਏ ਅਤੇ ਜੇਕਰ ਇਹਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਗੁਰਬਾਣੀ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਹੀ ਕੀਤੀ ਹੈ ਅਤੇ ਜੇਕਰ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪੰਜਾਬੀ ਭਾਸ਼ਾ ਨੂੰ ਹੀ ਪ੍ਰੈਫਸ ਕੀਤਾ ਏ ਅਤੇ ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਉਹਨਾਂ ਨੇ ਆਪਣੀ ਗੁਰਬਾਣੀ ਜ਼ਰੂਰ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ ਪਰ ਫਿਰ ਵੀ ਉਸ ਤੋਂ ਬਾਅਦ ਉਹਨਾਂ ਨੇ ਮ ਇਹਨੂੰ ਪੰਜਾਬੀ ਵਿੱਚ ਹੀ ਦਰਜ ਕੀਤਾ ਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਨੂੰ ਪੜ੍ਹਨਾ ਬਹੁਤ ਹੀ ਸੌਖਾ ਅਤੇ ਈਜ਼ੀ ਹੈ ਇਸ ਨੂੰ ਸਮਝਣਾ ਵੀ ਬੜਾ ਸੌਖਾ ਹੈ ਕਿ ਪੰਜਾਬੀ ਜਿਹੜੇ ਆ ਉਹ ਹਰ ਜਗ੍ਹਾ 'ਤੇ ਆਪਣੀ ਭਾਸ਼ਾ ਨੂੰ ਮਾਣ ਬਖਸ਼ਦੇ ਨੇ ਅਤੇ ਅਸੀਂ ਛੋਟੇ ਹੁੰਦੇ ਤੋਂ ਹੀ ਪੰਜਾਬੀ ਬੋਲਦੇ ਆ ਰਹੇ ਐਂ ਕਿਉਂਕਿ ਸਾਨੂੰ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਣ ਦਾ ਅਧਿਕਾਰ ਸਭ ਤੋਂ ਪਹਿਲਾਂ ਹੈ ਅਸੀਂ ਇਸ ਲਈ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਹੀ ਪ੍ਰੈਫਸ ਦਿੰਦੇ ਹਾਂ ਮੈਨੂੰ ਪੰਜਾਬੀ ਹੋਣ 'ਤੇ ਬਹੁਤ ਮਾਣ ਹੈ ਕਿਉਂਕਿ ਮੈਂ ਪੰਜਾਬੀ ਬੋਲਣ ਵਿੱਚ ਬਹੁਤ ਜ਼ਿਆਦਾ ਇੰਟਰਸਟਡ ਹਾਂ ਮੈਂ ਹਰ ਗੱਲ ਨੂੰ ਪੰਜਾਬੀ ਵਿੱਚ ਕਰਨਾ ਪਸੰਦ ਕਰਦੀ ਹਾਂ ਹਰ ਗੱਲ ਨੂੰ ਪੰਜਾਬੀ ਵਿੱਚ ਹੀ ਸੁਣਨਾ ਪਸੰਦ ਕਰਦੀ ਹਾਂ ਇਸ ਲਈ ਮੈਂ ਪੰਜਾਬੀ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਬਹੁਤ ਸਾਰੇ ਗੀਤ ਬਹੁਤ ਸਾਰੀਆਂ ਗੱਲਾਂ ਜੋ ਕਿ ਪੰਜਾਬੀ ਵਿੱਚ ਸੁਣਨਾ ਪਸੰਦ ਕਰਦੀ ਹਾਂ ਤਾਂ ਮੈਂ ਰੋਜ਼ ਸੁਣਦੀ ਹਾਂ ਇਸ ਲਈ ਮੈਨੂੰ ਪੰਜਾਬੀ ਹੋਣ ਦੇ ਬਹੁਤ ਹੀ ਮਾਣ ਹੈ